ਸਿਹਤ ਅਤੇ ਤੰਦਰੁਸਤੀ ਲਈ ਤੈਰਾਕੀ ਬਹੁਤ ਹੀ ਜ ਜ਼ਰੂਰੀ ਅਤੇ ਸਹੀ ਤਰੀਕਾ ਹੈ ਜਿਸ ਨੂੰ ਲੈ ਕੇ ਅਸੀਂ ਸਾਨੂੰ ਬਹੁਤ ਸਾਰੀਆਂ ਤੰਦਰੁਸਤੀਆਂ ਮਿਲਦੀਆਂ ਹਨ ਜਿਵੇਂ ਕਿ ਇੱਕ ਸਰੀਰ ਆਪਣਾ ਤੰਦਰੁਸਤ ਰਹਿੰਦਾ ਹੈ ਅਤੇ ਜਿਸ ਨੂੰ ਕਿ ਲੈ ਕੇ ਫਿੱਟਨੈਸ ਹੋ ਗਈ ਜਿਵੇਂ ਕਿ ਆਪਣੇ ਸ ਸਾਡਾ ਪਾਣੀ ਦੇ ਵਿੱਚ ਕਿੰਨਾ ਟਾਈਮ ਅੰਦਰ ਰਹਿਣਾ ਉਸ ਦੇ ਨਾਲ ਸਾਡਾ ਸਟੈਮਿਨਾ ਵਧਦਾ ਹੈ ਅਤੇ ਦਿਲ ਸਾਡਾ ਉਹ ਕਿੰਨੀ ਵਾਰੀ ਧੜਕਦਾ ਹੈ ਤੇ ਅਤੇ ਸਾਹ ਦਾ ਮਤਲਬ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਜਿਹਨੂੰ ਕਿ ਮਤਲਬ ਸਾਡੇ ਸਰੀਰ ਵਿੱਚ ਬਹੁਤ ਹੀ ਜ਼ਰੂਰੀ ਹੈ ਸਵੀਮਿੰਗ ਕਰਨ ਨਾਲ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਤੁਸੀਂ ਆਪਣਾ ਸਿਹਤ ਬੜੀ ਅੱਛੀ ਤਰ੍ਹਾਂ ਹੁੰਦੀ ਹੈ ਤੇ ਅਤੇ ਐਕਸਰਸਾਈਜ਼ ਦੇ ਵੀ ਬਹੁਤ ਹੀ ਜ਼ਰੂਰੀ ਪਾਟ ਹੈ ਇੱਕ ਜਿੱਦਾਂ ਹੈ ਆਪਾਂ ਆਪਣੀ ਸਿਹਤ ਨੂੰ ਤੰਦਰੁਸਤੀ ਰੱਖਣ ਲਈ ਐਕਸਰਸਾਈਜ ਕਰਦੇ ਹਾਂ ਯੋਗਾ ਕਰਦੇ ਹਾਂ ਇਸ ਸਾਰੇ ਲਈ ਮਤਲਬ ਕਿ ਜੇ ਅਸੀਂ ਸਵੀਮਿੰਗ ਕਰਦੇ ਹਾਂ ਇੱਕ ਸਾਡਾ ਪਾਣੀ ਦੇ ਅੰਦਰ ਰਹਿਣ ਨਾਲ ਬੜਾ ਮਤਲਬ ਇਸ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ ਸਾਨੂੰ ਯੋਗਾ ਜਾਂ ਸੈਰ ਦੀ ਕੋਈ ਜ਼ਰੂਰਤ ਨਹੀਂ ਜੇ ਅਸੀਂ ਦਿਨ 'ਚ ਦੋ ਤਿੰਨ ਘੰਟੇ ਵੀ ਸਵੀਮਿੰਗ ਕਰਦੇ ਹਾਂ ਜੋ ਕਿ ਸਾਡੇ ਸਿਹਤ ਲਈ ਬਹੁਤ ਹੀ ਜ਼ਰੂਰੀ ਅਤੇ ਫਾਇਦੇਮੰਦ ਰਹਿੰਦਾ ਹੈ